ਭੰਗੜੇ ਨੂੰ ਕਰਨ ਵਾਸਤੇ ਆਮ ਤੌਰ 'ਤੇ ਧੋਤੀ ਕੁੜਤਾ ਪਾਇਆ ਜਾਂਦਾ ਹੈ ਧੋਤੀ ਕੁੜਤਾ ਅਤੇ ਕੁੜਤੇ ਦੇ ਉੱਪਰ ਇੱਕ ਜੈਕਟ ਪਾਈ ਜਾਂਦੀ ਹੈ ਜੈਕਟ ਪਾ ਕੇ ਉਹਦੇ ਉੱਪਰ ਤੁਰਲੇ ਵਾਲੀ ਪੱਗ ਬੰਨ੍ਹੀ ਜਾਂਦੀ ਹੈ ਤੁਰਲੇ ਵਾਲੀ ਪੱਗ ਤੋਂ ਬਾਅਦ ਗਲੇ ਦੇ ਵਿੱਚ ਕੈਂਠਾ ਪਾਇਆ ਜਾਂਦਾ ਹੈ ਅਤੇ ਹੱਥ ਵਿੱਚ ਇੱਕ ਸੋਟੀ ਫੜੀ ਜਾਂਦੀ ਹੈ ਅਤੇ ਪੰਜਾਬੀ ਜੁੱਤੀ ਪਾਈ ਜਾਂਦੀ ਹੈ ਇਹ ਇਹ ਸਾਰੇ ਕੱਪੜੇ ਮਤਲਬ ਕਿ ਬਰਾਈਟ ਕਲਰ ਦੇ ਹੁੰਦੇ ਹਨ ਬਰਾਈਟ ਮਤਲਬ ਸੋਹਣੇ ਰੰਗਾਂ ਦੇ ਹੁੰਦੇ ਹਨ ਕੋਈ ਲਾਲ ਪੀਲੇ ਹਰੇ ਨੀਲੇ ਬ੍ਰ ਸੋਹਣੇ ਕਲਾ ਸੋਹਣੇ ਕਲਰਾਂ ਦੇ ਰੰਗ ਬਿਰੰਗੇ ਕੱਪੜੇ ਪਾਏ ਜਾਂਦੇ ਨੇ ਇਹ ਲੋਕਾਂ ਨੂੰ ਹੋਰ ਵੀ ਜ਼ਿਆਦਾ ਅਕਰਸ਼ਿਤ ਕਰਦੇ ਹਨ ਇਹ ਭੰਗੜਾ ਉਦੋਂ ਪਾਇਆ ਜਾਂਦਾ ਇਹ ਜਦੋਂ ਘਰ ਦੇ ਵਿੱਚ ਕੋਈ ਖੁਸ਼ੀ ਹੋਵੇ ਜਾਂ ਕੋਈ ਵਿਆਹ ਦਾ ਮੌਕਾ ਹੋਵੇ ਇਹ ਜਿਹੜੇ ਕੱਪੜੇ ਹਨ ਇਹ ਵਧੀਆ ਖਾਸ ਮੌਕਿਆਂ 'ਤੇ ਪਾਏ ਜਾਂਦੇ ਹਨ ਇਹਨਾਂ ਕੱਪੜਿਆਂ ਨੂੰ ਪਾਉਣ ਦਾ ਇੱਕ ਕਾਰਨ ਹੁੰਦਾ ਕਿ ਜਿਹੜਾ ਤੁਸੀਂ ਆਪਣੇ ਦਿਲ ਦੇ ਜ਼ਾਹਰਾਂ ਦਿਲ ਦੇ ਖਿਆਲਾਂ ਨੂੰ ਕਿਵੇਂ ਪ੍ਰਗਟ ਕਰ ਸਕਦੇ ਹੋ ਜਦੋਂ ਤੁਹਾਡਾ ਮਨ ਬਹੁਤ ਖੁਸ਼ ਹੁੰਦਾ ਹੈ ਜਦੋਂ ਤੁਸੀਂ ਇਹਨਾਂ ਇਹਦੇ ਇਸ ਕਰਕੇ ਖੁਸ਼ ਹੁੰਦੇ ਹੋ ਅਤੇ ਖੁਸ਼ ਹੋਣ ਕਰਕੇ ਤੁਸੀਂ ਆਪਣੇ ਦਿਲ ਦੇ ਜਿਹੜੇ ਸਾਰੇ ਉਹ ਹੈਗੇ ਨੇ ਜੋ ਤੁਸੀਂ ਚੀਜ਼ਾਂ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹੋ ਤੁਸੀਂ ਬਾਹਰ ਕਰਨਾ ਚਾਹੁੰਦੇ ਹੋ ਇਸ ਕਰਕੇ ਤੁਸੀਂ ਭੰਗੜਾ ਪਾਉਂਦੇ ਹੋ ਇਹਨਾਂ ਭੰਗੜਾ ਪਾਉਣ ਵਾਸਤੇ ਇਹ ਪੋਸ਼ਾਕ ਪਾਈ ਜਾਂਦੀ ਹੈ ਭੰਗੜਾ ਪਾਉਣ ਵਾਲਿਆਂ ਦੇ ਕੱਪੜੇ ਬਹੁਤ ਮਤਲਬ ਕਿ ਰੰਗ ਬਿਰੰਗੇ ਸੋਹਣੇ ਪਾਏ ਜਾਂਦੇ ਆ ਜੋ ਕਿ ਦੂਜਿਆਂ ਨੂੰ ਵੀ ਨੱਚਣ 'ਤੇ ਮਜ਼ਬੂਰ ਕਰਦੇ ਆ ਭੰਗੜਾ ਇੰਨਾ ਸੋਹਣਾ ਪਾਇਆ ਜਾਂਦਾ ਹੈ ਕਿ ਜਿਹੜਾ ਲੋਕ ਕੋਲ ਖੜ੍ਹੇ ਹੁੰਦੇ ਹਨ ਕੋਈ ਗੱਭਰੂ ਮੁਟਿਆਰਾਂ ਜਿਹੜੀਆਂ ਖੜ੍ਹੀਆਂ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਉਹ ਵੀ ਭੰਗੜਾ ਪਾਉਣ